ਮੈਂ ਦੋ ਹਫਤੇ ਪਹਿਲਾਂ ਇੱਕ ਕੈਮਰਾ ਮੰਗਵਾਇਆ ਜਿਹਦੀ ਮੈਨੂੰ ਹਲੇ ਤੱਕ ਕੋਈ ਅਪਡੇਟ ਨਹੀਂ ਮਿਲੀ ਹੈ ਠੀਕ ਹੈ ਮੈਂ ਉਹਨਾਂ ਦੀ ਆਨਲਾਈਨ ਵੈਬਸਾਈਟ ਦੇ ਉੱਤੇ ਵੀ ਜਾ ਕੇ ਉਹਨਾਂ ਨੂੰ ਕਿੰਨੇ ਮੈਸੇਜਿਸ ਵਗੈਰਾ ਅਤੇ ਮੇਲ ਕਰ ਚੁੱਕੀ ਆ ਜਿਹਦੇ ਕਰਕੇ ਮੈਨੂੰ ਬਹੁਤ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਠੀਕ ਹੈ ਮੈਂ ਉਹਦੀ ਆਨਲਾਈਨ ਪੇਮੈਂਟ ਕਰ ਵੀ ਚੁੱਕੀ ਹਾਂ ਠੀਕ ਹੈ ਜਿਹਦੇ ਕਰਕੇ ਮੈਨੂੰ ਘਰੋਂ ਗਾਲਾਂ ਵੀ ਪੈ ਚੁੱਕੀਆਂ ਨੇ ਅਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਮੈਂ ਉਹਨਾਂ ਦੇ ਜੋ ਉਹਨਾਂ ਦੇ ਐਮਜ਼ੋਨ ਦਾ ਮੇਨ ਹੈਡ ਹੈ ਮੈਂ ਉਹਨਾਂ ਨੂੰ ਵੀ ਮੇਲ ਕਰ ਚੁੱਕੀ ਹਾਂ ਉਹਨਾਂ ਦਾ ਵੀ ਮੈਨੂੰ ਕੋਈ ਵੀ ਰਿਪਲਾਈ ਨਹੀਂ ਆਇਆ ਹੈ ਠੀਕ ਹੈ ਜਿਸ ਕਰਕੇ ਮੈਨੂੰ ਆਪਣੇ ਪ੍ਰੋਡਕਟ ਦਾ ਜੋ ਗੈਜਟ ਆ ਮੇਰਾ ਕੈਮਰਾ ਮੈਨੂੰ ਉਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਮੈਨੂੰ ਉਹਦੀ ਜਾਣਕਾਰੀ 'ਚ ਮੈਨੂੰ ਉਹਦੀ ਜਾਣਕਾਰੀ ਲਈ ਕੀ ਕਹਿੰਦੇ ਆ ਉਹਨਾਂ ਦੀ ਵੈਬਸਾਈਟ ਦੇ ਉੱਤੇ ਦੁਬਾਰਾ ਇੱਕ ਹਫਤੇ ਬਾਅਦ ਮੈਂ ਫਿਰ ਮੇਲ ਕੀਤੀ ਹੈ ਬਟ ਉਹਨਾਂ ਦਾ ਮੈਨੂੰ ਫਿਰ ਵੀ ਕੋਈ ਰਿਪਲਾਈ ਨਹੀਂ ਆਇਆ ਇਸ ਕਰਕੇ ਮੈਂ ਉਹਨਾਂ ਦੀ ਦੁਬਾਰਾ ਵੈਬਸਾਈਟ ਦੇ ਉੱਤੇ ਦੂਸਰੀ ਵੈਬਸਾਈਟ ਦੇ ਉੱਤੇ ਉਹਨਾਂ ਦੇ ਨੰਬਰ ਦੇ ਉੱਤੇ ਵਟਸਅਪ ਦੇ ਉੱਤੇ ਉਹਨਾਂ ਨੂੰ ਮੈਸੇਜਿਸ ਕੀਤੇ ਨੇ ਕਿ ਮੇਰਾ ਅਪਡੇਟ ਮੇਰਾ ਜੋ ਗੈਜੇਟ ਆ ਮੈਨੂੰ ਉਹਦੀ ਅਪਡੇਟ ਦੋ ਉਹਦੀ ਡਿਲੀਵਰੀ ਕਦੋਂ ਹੋ ਜਾਏਗੀ ਜਾਂ ਮੈਨੂੰ ਉਹਨਾਂ ਦੀ ਡਿਲੀਵਰੀ ਦਾ ਮੈਨੂੰ ਕੋਈ ਡੇਟ ਔਰ ਮੈਨੂੰ ਕੋਈ ਟਾਈਮ ਦੱਸੋ ਜਾਂ ਮੈਨੂੰ ਉਹਨਾਂ ਦੇ ਮੈਂ ਆਨਲਾਈਨ ਪੇਮੈਂਟ ਕਰ ਚੁੱਕੀ ਹਾਂ ਜੋ ਕਿ ਮੈਨੂੰ ਉਹਦੇ ਕੋਈ ਵੀ ਰਿਵਿਊ ਨਹੀਂ ਮਿਲ ਰਿਹਾ